ਹਰ ਦੇਸ਼ ਪ੍ਰਾਂਤ ਸਮਾਜ ਵਿੱਚ ਮੇਲਿਆਂ ਦਾ ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ ਸਮਾਗਮ ਦਾ ਆਪਣਾ ਮਹੱਤਵ ਹੁੰਦਾ ਹੈ ਇਹਨਾਂ ਸਮਾਗਮਾਂ ਦਾ ਆਪਣਾ ਇਤਿਹਾਸਿਕ ਅਤੇ ਮਿਥਿਹਾਸਿਕ ਪਿਛੋਕੜ ਹੁੰਦਾ ਹੈ ਪੰਜਾਬ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਸਮਾਗਮ ਮਨਾਏ ਜਾਂਦੇ ਹਨ ਜਿੱਥੇ ਕਿ ਲੋਕ ਹਰ ਵੇਲੇ ਹਾਜ਼ਰ ਹੋਣ ਲਈ ਤਿਆਰ ਰਹਿੰਦੇ ਹਨ ਅਤੇ ਉੱਥੋਂ ਦਾ ਆਨੰਦ ਲੈਂਦੇ ਹਨ ਜਿਵੇਂ ਕਿ ਪੰਜਾਬ ਦੇ ਵਿੱਚ ਖ਼ਾਸ ਕਰਕੇ ਮਨਾਏ ਜਾਂਦੇ ਹੋਲੇ ਮਹੱਲੇ ਦਾ ਸਮਾਗਮ ਹੁੰਦਾ ਹੈ ਲੋਹੜੀ ਦੇ ਸਮਾਗਮ ਹੁੰਦੇ ਹਨ ਪੰਜਾਬ ਵਿਚਲੇ ਜਿਹੜੇ ਪ੍ਰਮੁੱਖ ਜਿਹੜੇ ਮੇਲੇ ਮਨਾਏ ਜਾਂਦੇ ਹਨ ਸਮਾਗਮ ਮਨਾਏ ਜਾਂਦੇ ਹਨ ਦੁਸਹਿਰੇ ਅਤੇ ਦਿਵਾਲੀ ਅਤੇ ਵਿਸਾਖੀ ਬਸੰਤ ਹੋਲੀ 'ਤੇ ਮਨਾਏ ਜਾਂਦੇ ਹਨ ਇਹ ਸਰਬ ਸਾਂਝੇ ਤਿਉਹਾਰ ਹੁੰਦੇ ਹਨ ਸਮਾਗਮ ਹੁੰਦੇ ਹਨ ਹਰ ਕਸਬੇ ਹਰ ਸ਼ਹਿਰ ਹਰ ਪਿੰਡ ਵਿੱਚ ਮਨਾਏ ਜਾਂਦੇ ਹਨ ਕਿਸੇ ਇੱਕ ਸਥਾਨ ਵਿੱਚ ਸਾਰੀ ਹਰ ਮੇਲੇ ਦੀ ਪ੍ਰਸਿੱਧਤਾ ਜਿਹੜੀ ਹੈ ਨਾ ਇੱਕ ਸਥਾਨ 'ਚ ਜੁੜੀ ਹੁੰਦੀ ਹੈ ਜਿਵੇਂ ਦੀਵਾਲੀ ਅੰਮ੍ਰਿਤਸਰ ਦੀ ਵਧੇਰੇ ਮਸ਼ਹੂਰ ਹੈ ਬਸੰਤ ਦਾ ਮੇਲਾ ਵਿਸ਼ੇਸ਼ ਕਰਕੇ ਛਿਹਾਟਾ ਸਾਹਿਬ ਮਨਾਇਆ ਜਾਂਦਾ ਵਿਸਾਖੀ ਦਾ ਮੇਲਾ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਲੋਹੜੀ ਦਾ ਮੁਕਤਸਰ ਸਾਹਿਬ ਵਿਖੇ ਬਹੁਤ ਜ਼ਿਆਦਾ ਤਿਉਹਾਰ ਮਨਾਇਆ ਜਾਂਦਾ ਹੈ ਮਾਘੀ ਦਾ ਮੇਲਾ ਕਹਿੰਦੇ ਇਹਨੂੰ ਹੋਲਾ ਮਹੱਲਾ ਜਿਹੜਾ ਉਹ ਅਨੰਦਪੁਰ ਸਾਹਿਬ 'ਚ ਮਨਾਇਆ ਜਾਂਦਾ ਜਿੱਥੇ ਲੋਕ ਹੁੰਮ ਹੁਮਾ ਕੇ ਪਹੁੰਚਦੇ ਨੇ ਉੱਥੇ ਰਾਜਨੀਤਿਕ ਸਮਾਗਮ ਕੀਤੇ ਜਾਂਦੇ ਨੇ ਰਾਜਨੀਤਿਕ ਲੋਕ ਇਕੱਠੇ ਹੋਏ ਹੁੰਦੇ ਨੇ ਉਹ ਆਪਣੇ ਆਪਣੇ ਇਹਨਾਂ ਮੇਲਿਆਂ ਦੀ ਮਹੱਤਤਾ ਨੂੰ ਦੱਸਦੇ ਹਨ ਲੋਕ ਇਹਨਾਂ ਸਮਾਗਮਾਂ ਨੂੰ ਦੇਖਣ ਲਈ ਹਰ ਵੇਲੇ ਤਿਆਰ ਰਹਿੰਦੇ ਹਨ ਜਾਣਾ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ ਆਨੰਦ ਲੈਂਦੇ ਹਨ ਇਹਨਾਂ ਮੇਲਿਆਂ ਦਾ ਸਾਲ ਬਾਅਦ ਜਦੋਂ ਇਹ ਤਿਉਹਾਰ ਆਉਂਦੇ ਹਨ ਲੋਕ ਆਪਣੇ ਹਰ ਕੰਮ ਛੱਡ ਕੇ ਇਹਨਾਂ ਮੇਲਿਆਂ ਵਿੱਚ ਪਹੁੰਦੇ ਹਨ ਸੱਭ ਸੱਭਿਆਚਾਰਕ ਮੇਲੇ ਹੁੰਦੇ ਹਨ ਕਈ ਸਾਲਾਂ ਤੋਂ ਜਿਵੇਂ ਬਠਿੰਡੇ ਅਤੇ ਫਰੀਦਕੋਟ ਵਿੱਚ ਪੇਂਡੂ ਮੇਲੇ ਬੜੇ ਵੱਡੇ ਪੱਧਰ 'ਤੇ ਮਨਾਏ ਜਾ ਰਹੇ ਹਨ ਕਈ ਪਿੰਡਾਂ ਸ਼ਹਿਰਾਂ ਛੋਟੇ ਛੋਟੇ ਕਲਾਕਾਰਾਂ ਨੂੰ ਬੁਲਾ ਕੇ ਸਭਿਆਚਾਰ ਪ੍ਰੋਗਰਾਮ ਕਰਾਏ ਜਾਂਦੇ ਹਨ ਜਲੰਧਰ ਵਿੱਚ ਦੇਸ਼ ਭਗਤ ਯਾਦਗਰੀ ਹਾਲ ਵਿੱਚ ਗਦਰੀਆਂ ਦਾ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਆਪਣੀ ਵਿਸ਼ੇਸ਼ ਪਛਾਣ ਬਣਾ ਚੁੱਕਾ ਹੈ ਪੰਜਾਬ ਦੇ ਕਈ ਪਿੰਡਾਂ ਵਿੱਚ ਵੱਖ ਵੱਖ ਨਾਟ ਮੰਡੀਆਂ ਵੱਲੋਂ ਵੀ ਨਾਟ ਮੇਲੇ ਕਰਾਏ ਜਾਂਦੇ ਰਹੇ ਹਨ